ਮੈਂ ਗਾਣੇ ਗਾਉਂਦਾ ਹਾਂ ਅਤੇ ਮੇਰਾ ਭਰਾ ਗਾਣੇ ਗਾਉਣੇ ਸਿੱਖਣਾ ਚਾਹੁੰਦਾ ਹੈ ਠੀਕ ਹੈ ਅ ਗਾਣੇ ਗਾਣਾ ਸਿੱਖਦਾ ਅ ਗਾਣੇ ਗਾਉਣਾ ਸਿੱਖਦਾ ਸਿੱਖਣਾ ਹੈ ਉਸਨੇ ਉਸ ਤੋਂ ਬਾਅਦ ਉਹ ਜੇਕਰ ਕੋਈ ਸਾਡੇ ਘਰ ਵਿੱਚ ਕੋਈ ਵੀ ਫੰਕਸ਼ਨ ਹੋਵੇ ਤਾਂ ਮੇਰਾ ਭਰਾ ਕੋਈ ਗਾਣਾ ਨਹੀਂ ਗਾਉਂਦਾ ਹਰੇਕ ਫੰਕਸ਼ਨ ਵਿੱਚ ਮੈਨੂੰ ਹੀ ਗਾਣੇ ਗਾਉਣੇ ਪੈਂਦੇ ਹਨ ਅਤੇ ਉਹ ਗਾਣੇ ਸਿੱਖ ਮੇਰਾ ਭਰਾ ਗਾਣੇ ਸਿੱਖਣ ਲਈ ਮੈਨੂੰ ਕਹਿੰਦਾ ਹੈ ਅਤੇ ਮੈਂ ਉਸਨੂੰ ਗਿਟਾਰ ਵੀ ਲਿਆ ਕੇ ਦਿੱਤਾ ਪਰ ਉਸ ਨੂੰ ਬੀਟਾਂ ਨਹੀਂ ਬਣਾਉਣੀਆਂ ਆਉਂਦੀਆਂ ਅਤੇ ਮੈਂ ਉਸਨੂੰ ਕਿਹਾ ਵੀ ਤੂੰ ਰੋਜ਼ ਹੀ ਚਾਰ ਪੰਜ ਗਾਣੇ ਸੁਣਿਆ ਕਰ ਪਰ ਜ਼ਿਆਦਾ ਧਿਆਨ ਬੀਟਾਂ ਦੇ ਉੱਪਰ ਹੀ ਦਿਆ ਕਰ ਅਤੇ ਉਸ ਤੋਂ ਬਾਅਦ ਫਿਰ ਉਸਨੂੰ ਮੈਂ ਕਿਹਾ ਫਿਰ ਤੂੰ ਬੀਟਾਂ ਬਣਾ ਕੇ ਗਾਣੇ ਗਾਇਆ ਕਰ ਉਸ ਦੇ ਨਾਲ਼ ਹੀ ਗਿਟਾਰ ਦੇ ਨਾਲ਼ ਅਤੇ ਫਿਰ ਉਸ ਨੇ ਹੌਲ਼ੀ ਹੌਲ਼ੀ ਗਾਣੇ ਦੀਆਂ ਬੀਟਾਂ ਬਣਾਉਣੀਆਂ ਸਿੱਖ ਲਈਆਂ ਪਰ ਜਦ ਸਾਡੇ ਘਰ ਵਿੱਚ ਪ੍ਰੋਗਰਾਮ ਹੋਇਆ ਤਾਂ ਉਸ ਨੂੰ ਹੀ ਮੈਂ ਕਿਹਾ ਵੀ ਤੂੰ ਹੀ ਅੱਜ ਗਾਣੇ ਗਾ ਠੀਕ ਹੈ ਓਕੇ